ਮੈਂ ਸਿੱਖ ਧਰਮ ਤੋਂ ਬਿਲੋਂਗ ਕਰਦਾ ਹਾਂ ਜਿਹਦੇ ਵਿੱਚ ਕਿ ਦਸ ਗੁਰੂ ਸਾਹਿਬਾਨ ਆਉਂਦੇ ਹਨ ਅਤੇ ਉਹ ਦਸੇ ਦੇ ਦਸੇ ਹੀ ਮੇਰੇ ਮਨ ਪਸੰਦੀਦਾ ਹਨ ਕਿਉਂਕਿ ਉਹਨਾਂ ਦਸਾਂ ਤੋਂ ਕੁਛ ਨਾ ਕੁਛ ਮੈਨੂੰ ਸਿੱਖਣ ਨੂੰ ਮਿਲਦਾ ਹੈ ਅਤੇ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਕੀਤੇ ਕੀਤੀਆਂ ਹਨ ਜਾਂ ਕੌਤਕ ਕੀਤੇ ਹਨ ਜਿਹਦੇ ਕਰਕੇ ਕਿ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਦੁਨੀਆਂ 'ਚ ਕਿਵੇਂ ਵਿਚਰਨਾ ਹੈ ਹਰ ਕਿਸੇ ਨਾਲ ਕਿੱਦਾਂ ਗੱਲ ਕਰਨੀ ਹੈ ਕਿ ਸਾਨੂੰ ਫਿਜੀਕਲ ਫਿਜੀਕਲ ਤੋਂ ਫਿਜੀਕਲ ਸਟਰੈਂਥ ਤੋਂ ਲੈ ਕੇ ਮੈਂਟਲ ਸਟਰੈਂਥ ਕਿੱਦਾਂ ਅਟੇਨ ਕਰਨੀ ਹੈ ਜਾਂ ਉਸ ਚੀਜ਼ ਤੱਕ ਕਿੱਦਾਂ ਪਹੁੰਚਣਾ ਉਸ ਕੋਨਸ਼ੀਅਸਨੈਸ ਤੱਕ ਕਿੱਦਾਂ ਪਹੁੰਚਣਾ ਹੈ ਅਤੇ ਫਿਰ ਉਹਦੇ ਬਾਅਦ ਆਪਾਂ ਨੂੰ ਜਿੱਦਾਂ ਕਿ ਆਪਾਂ ਉਹ ਸਾਨੂੰ ਵੇ ਆਫ ਲਿਵਿੰਗ ਵੀ ਸਿਖਾਉਂਦੇ ਆ ਕਿ ਜੇ ਆਪਾਂ ਰੱਬ ਦਾ ਨਾਂ ਲਵਾਂਗੇ ਤਾਂ ਫਿਰ ਅਸੀਂ ਹਰ ਇੱਕ ਮਾੜੀ ਚੀਜ਼ਾਂ ਤੋਂ ਬਚੇ ਰਹਾਂਗੇ ਸਾਡੇ ਦੇ ਸਾਡੇ ਵਿੱਚ ਕਾਮ ਕ੍ਰੋਧ ਲੋਭ ਮੋਹ ਨਹੀਂ ਆਊਗਾ ਜੇ ਅਸੀਂ ਰੱਬ ਦਾ ਨਾਮ ਲਵਾਂਗੇ ਅਤੇ ਇਹਨਾਂ ਬਾਰੇ ਮੈਨੂੰ ਆਪਣੇ ਫੈਮਿਲੀ ਮੈਂਬਰਸ ਤੋਂ ਪਤਾ ਲੱਗਿਆ ਉਹ ਛੋਟੇ ਹੋਣ ਤੋਂ ਮੈਨੂੰ ਹਰ ਵਾਰ ਪਾਠ ਕਰਨ ਮੈਨੂੰ ਪਾਠ ਕਰਨ ਨੂੰ ਕਹਿੰਦੇ ਸੀਗੇ ਫਿਰ ਮੈਨੂੰ ਗੁਰਦੁਆਰੇ ਲੈ ਕੇ ਜਾਂਦੇ ਸੀਗੇ ਜਿਹਦੇ ਕਰਕੇ ਕਿ ਮੈਨੂੰ ਲੱਗਿਆ ਕਿ ਨਹੀਂ ਮੈਂ ਵੀ ਉਹਨਾਂ ਨਾਲ ਗੱਲ ਕਰ ਸਕਦਾ ਹਾਂ ਅਤੇ ਮੇਰਾ ਸੁਪਨਾ ਵੀ ਹੈ ਕਿ ਮੈਂ ਰੱਬ ਨਾਲ ਬਹਿ ਕੇ ਗੱਲਾਂ ਕਰਾਂ ਅਤੇ ਫਿਰ ਉਹਦੇ ਬਾਅਦ ਆਪਣਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਪਾਠ ਕਰਕੇ ਗੁਰਦੁਆਰੇ ਜਾ ਕੇ ਬਹੁਤ ਮਨ ਨੂੰ ਸਕੂਨ ਮਿਲਦਾ ਹੈ ਅਤੇ ਫਿਰ ਉਹਦੇ ਬਾਅਦ ਮੈਨੂੰ ਕ ਜਪੁਜੀ ਸਾਹਿਬ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਹਿਲੀ ਪਹਿਲਾ ਪਾਠ ਹੈ ਕਿ ਜਿਹਨੂੰ ਪੜ੍ਹ ਕੇ ਇੱਦਾਂ ਲੱਗਦਾ ਹੈ ਕਿ ਉਹ ਸਾਡੀ ਜ਼ਿੰਦਗੀ ਦੇ ਵਿੱਚ ਉਹ ਸਾਡੀ ਜ਼ਿੰਦਗੀ ਦੇ ਬਾਰੇ ਦੱਸਦਾ ਪਿਆ ਫਿਰ ਉਹਦੇ ਬਾਅਦ ਜਿੱਦਾਂ ਕਿ ਸਾਡੇ ਦਸਾਂ ਗੁਰੂ ਸਾਹਿਬਾਨਾਂ ਨੇ ਕਿੱਦਾਂ ਆਪਣੇ ਆਪਣੀ ਜੀਵਨ ਜੀਆ ਫਿਰ ਉਹਦੇ ਵਿੱਚ ਕੀ ਕੀ ਕੰਮ ਕੀਤੇ ਕੀ ਕੀ ਕੌਤਕ ਕੀਤੇ ਅਤੇ ਫਿਰ ਉਹਦੇ ਬਾਅਦ ਦਸਵੇਂ ਗੁਰੂ ਨੇ ਕਿੱਦਾਂ ਆਪਣੇ ਬੱਚੇ ਵਾਰਤੇ ਹਿਉਮੈਨਿਟੀ ਕਰਕੇ ਕਿ ਕਿਸੇ ਧਰਮ ਨੂੰ ਬਚਾਉਣ ਵਾਸਤੇ